ਪੰਜਾਬ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਭਰਾਵਾਂ ਦੀ ਹੱਟੀ ਬਹੁਤ ਜ਼ਿਆਦਾ ਮਸ਼ਹੂਰ ਹੈ ਕੁੰਦਨ ਦਾ ਢਾਬਾ ਕੇਸਰ ਦਾ ਢਾਬਾ ਉਹ ਵੀ ਬਹੁਤ ਮਸ਼ਹੂਰ ਹੈ ਇੱਥੇ ਤੁਹਾਨੂੰ ਪ੍ਰੋਪਰ ਪੂਰਾ ਪੰਜਾਬੀ ਖਾਣਾ ਮਿਲੇਗਾ ਜੋ ਕਿ ਇੱਕ ਬਾਹਰ ਦੇ ਆਏ ਸੈਲਾਨੀ ਨੂੰ ਬਹੁਤ ਵਧੀਆ ਲੱਗੇਗਾ ਜਿਹੜਾ ਬਾਹਰੋਂ ਇੱਕ ਟੂਰਿਸਟ ਆ ਰਿਹਾ ਹੈ ਜੇ ਉਹਨੇ ਪ੍ਰੋਪਰ ਪੰਜਾਬੀ ਖਾਣਾ ਖਾਣਾ ਹੈ ਤਾਂ ਉਹ ਜਾਂ ਤਾਂ ਭਰਾਵਾਂ ਦੇ ਢਾਬੇ ਖਾ ਸਕਦਾ ਹੈ ਕੁੰਦਨ ਦਾ ਢਾਬਾ ਜਾਂ ਫਿਰ ਬ੍ਰਦਰਸ ਇੱਥੇ ਖਾ ਸਕਦਾ ਹੈ ਅਤੇ ਜਾਂ ਫਿਰ ਹੁਸ਼ਿਆਰਪੁਰੇ ਦੀ ਹੱਟੀ ਕਟਾਨੀ ਢਾਬਾ ਰਾਜ ਢਾਬਾ ਐਹ ਸਾਰੀ ਜਗ੍ਹਾਵਾਂ 'ਤੇ ਪ੍ਰੋਪਰ ਖਾਣਾ ਪੰਜਾਬੀ ਜਿਹਨੂੰ ਕੀ ਕਹਿੰਦੇ ਇੱਕ ਪੰਜਾਬੀ ਖਾਣਾ ਪੰਜਾਬੀ ਖਾਣਾ ਇੱਥੇ ਪ੍ਰੋਪਰਲੀ ਮਿਲਦਾ ਵੈ ਅਤੇ ਜਿਹੜੇ ਬਾਹਰੋਂ ਆਉਂਦੇ ਨੇ ਸੈਲਾਨੀ ਉਹਨਾਂ ਨੂੰ ਇੱਥੇ ਜ਼ਰੂਰ ਆ ਕੇ ਖਾਣਾ ਚਾਹੀਦਾ ਹੈ ਜਿਹਨਾਂ ਨੇ ਇੱਕ ਪ੍ਰੋਪਰ ਪੰਜਾਬੀ ਥਾਲੀ ਖਾਣੀ ਹੈ ਅਤੇ ਵੇਖਣਾ ਕਿ ਸਾਡੇ ਪੰਜਾਬੀ ਖਾਣੇ 'ਚ ਕੀ ਹੁੰਦਾ ਹੈ ਨਾਨ ਹੁੰਦਾ ਹੈ ਬਟਰ ਪਨੀਰ ਬਟਰ ਮਸਾਲਾ ਅਤੇ ਰੋਟੀ ਜਾਂ ਸਭ ਕੁਛ ਐਹ ਤੁਹਾਨੂੰ ਇੱਕ ਪ੍ਰੋਪਰ ਇੱਥੇ ਮਿਲੇਗਾ ਅਤੇ ਜੇ ਤੁਹਾਨੂੰ ਚਾਹੀਦਾ ਕੋਈ ਸਟਰੀਟ ਫੂਡ ਅੰਤਰਰਾਸ਼ਟਰੀ ਪਕਵਾਨ ਉਹ ਵੀ ਸਭ ਕੁਛ ਇੱਥੇ ਮਿਲੇਗਾ ਰਵਾਇਤੀ ਸਭ ਕੁਛ ਮਿਲਦਾ ਇੱਥੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪੰਜਾਬ ਦਾ ਟੇਸਟ ਮਿਲੇ ਅਤੇ ਤੁਹਾਨੂੰ ਉਹ ਵਾਲੀ ਜਗ੍ਹਾਵਾਂ 'ਤੇ ਜਾਣਾ ਚਾਹੀਦਾ ਹੈ ਜਿੱਥੇ ਮੈਂ ਤੁਹਾਨੂੰ ਨਾਮ ਦੱਸਿਆ ਜਿਵੇਂ ਕਿ ਕੁੰਦਨ ਢਾਬਾ ਅਤੇ ਭਰਾਵਾਂ ਦੀ ਹੱਟੀ ਜੇ ਤੁਸੀਂ ਅੰਮ੍ਰਿਤਸਰ ਗੁਰੂ ਦੀ ਨਗਰੀ ਆ ਰਹੇ ਹੋ ਅਤੇ